ਅੱਜ ਦੇ ਸਮੇਂ ਵਿੱਚ ਭਾਰਤ ਨੇ ਕਾਫ਼ੀ ਵਿਕਾਸ ਕੀਤਾ ਹੈ ਇਸ ਵਿਕਾਸ ਦੇ ਨਾਲ ਨਾਲ ਪ੍ਰਦੂਸ਼ਣ ਦਾ ਵੀ ਕਾਫ਼ੀ ਸਮੱਸਿਆ ਹੋਈ ਹੈ ਅਸੀਂ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਕਾਫ਼ੀ ਤਰ੍ਹਾਂ ਦੇ ਪ੍ਰਦੂਸ਼ਣ ਹੁੰਦੇ ਆ ਜਿਹੜੇ ਕਿ ਅੱਜ ਕੱਲ੍ਹ ਸਮੱਸਿਆ ਦਾ ਕਾਰਣ ਬਣੇ ਹਨ ਜਿਵੇਂ ਹਵਾ ਪ੍ਰਦੂਸ਼ਣ ਪਾਣੀ ਦਾ ਪ੍ਰਦੂਸ਼ਣ ਇੱਦਾਂ ਦੇ ਕਾਫ਼ੀ ਆਦਿ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਨੇ ਹਵਾ ਦਾ ਪ੍ਰਦੂਸ਼ਣ ਹੁੰਦਾ ਜਿੱਦਾਂ ਕਿ ਫੈਕਟਰੀਆਂ ਵਿੱਚ ਲੋਕ ਕੰਮ ਕਰਦੇ ਨੇ ਅਤੇ ਉਸ ਦਾ ਧੂੰਆਂ ਇੱਦਾਂ ਹੀ ਛੱਡ ਦਿੰਦੇ ਨੇ ਜਿਸ ਤਰ੍ਹਾਂ ਓਜੋਨ ਦੀ ਲੇਅਰ ਵਿੱਚ ਵੀ ਛੇਦ ਹੋ ਗਏ ਨੇ ਅਤੇ ਵਾਤਾਵਰਨ ਦੇ ਜਿਹੜੇ ਪ੍ਰਦੂਸ਼ਣ ਹੋਣ ਨਾਲ ਕਈਆਂ ਨੂੰ ਸਾਂਸ ਲੈਣ ਵਿੱਚ ਕੋਈ ਦਿੱਕਤ ਹੁੰਦੀ ਆ ਅਤੇ ਜਿਹੜੇ ਬਿਮਾਰੀਆਂ ਨਾਲ ਗ੍ਰਸਤ ਨੇ ਜਾਂ ਜਿਹੜੇ ਉਮਰ ਵਿੱਚ ਵੱਡੇ ਨੇ ਉਹਨਾਂ ਨੂੰ ਵੀ ਕਾਫ਼ੀ ਦਿੱਕਤ ਹੁੰਦੀ ਹੈ ਸਾਹ ਲੈਣ ਦੇ ਵਿੱਚ ਅਤੇ ਇਸ ਤੋਂ ਇਲਾਵਾ ਅਸੀਂ ਪਾਣੀ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਲੋਕ ਵਿੱਚ ਕਾਫ਼ੀ ਲੋਕ ਕੁਝ ਲਾਪਰਵਾਹ ਨੇ ਅਤੇ ਉਹ ਪਾਣੀ ਵਿੱਚ ਹੀ ਕੂੜਾ ਸੁੱਟ ਦਿੰਦੇ ਨੇ ਜਿਸ ਕਰਕੇ ਪਾਣੀ ਸਾਫ਼ ਨਹੀਂ ਹੁੰਦਾ ਨਦੀਆਂ ਨਾਲਿਆਂ ਨੂੰ ਦੇਖਣ ਵਿੱਚ ਵੀ ਕੁਝ ਪਤਾ ਨਹੀਂ ਆਉਂਦਾ ਅੱਜ ਕੱਲ੍ਹ ਤਾਂ ਜਿਹੜੀ ਜੀਵ ਹੈ ਪਾਣੀ ਦੇ ਜੀਵ ਉਹਨਾਂ ਨੂੰ ਵੀ ਕਾਫ਼ੀ ਦਿੱਕਤ ਹੁੰਦੀ ਹੈ ਸਾਨੂੰ ਆਪਣੇ ਵਾਤਾਵਰਨ ਦਾ ਖਿਆਲ ਰੱਖਣਾ ਚਾਹੀਦਾ ਵਾਤਾਵਰਨ ਦਾ ਖਿਆਲ ਰੱਖਾਂਗੇ ਤਾਂ ਅਸੀਂ ਤੰਦਰੁਸਤ ਜੀਵਨ ਜੀ ਸਕਦੇ ਹਾਂ ਇਸ ਕਰਕੇ ਪ੍ਰਦੂਸ਼ਣ ਦੇ ਸਮੱਸਿਆਵਾਂ ਨਾਲ ਨਾ ਮੌਸਮਾਂ ਵਿੱਚ ਵੀ ਕਾਫ਼ੀ ਬਦਲਾਅ ਹੁੰਦੇ ਨੇ ਜਿਵੇਂ ਗਰਮੀਆਂ ਵਿੱਚ ਵੀ ਇੰਨੀ ਗਰਮੀ ਨਹੀਂ ਲੱਗਦੀ ਕਈ ਵਾਰੀ ਕੁਝ ਜ਼ਿਆਦਾ ਗਰਮੀ ਹੋ ਜਾਂਦੀ ਗਲੋਬਲ ਵਾਰਮਿੰਗ ਜਿਸ ਤਰ੍ਹਾਂ ਦੀ ਕੁਛ ਸਮੱਸਿਆਵਾਂ ਹੋ ਜਾਂਦੀ ਹੈ ਬਰਸਾਤ ਵੀ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਦੇ ਆਉਂਦੀ ਹੈ ਕਦੇ ਜਾਂਦੀ ਹੈ ਇੱਦਾਂ ਦਾ ਮੌਸਮਾਂ ਵਿੱਚ ਵੀ ਕਾਫ਼ੀ ਬਦਲਾਅ ਆਉਂਦਾ ਹੈ ਸਾਨੂੰ ਆਪਣੇ ਵਾਤਾਵਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਦੇਸ਼ ਨੂੰ ਵੀ ਵਧੀਆ ਕਰ ਸਕੀਏ ਅਤੇ ਆਪਣਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰੱਖੀਏ ਜਿਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਹਰ ਇਨਸਾਨ ਦੇ ਅੰਦਰ ਇਹ ਜਾਗਰੂਕਤਾ ਪੈਦਾ ਕਰੀਏ ਕਿ ਉਹ ਆਪਣੇ ਵਾਤਾਵਰਨ ਦਾ ਖਿਆਲ ਰੱਖੇ